ਦੇਖਿਆ ਜਾਵੇ ਤਾਂ ਮੈਂ ਆਪਣੇ ਜੀਵਨ ਵਿੱਚ ਬਹੁਤ ਸਾਰੀਆਂ ਯਾਤਰਾਵਾਂ ਕੀਤੀਆਂ ਹਨ ਪਰ ਪਿਛਲੇ ਹੀ ਮਹੀਨੇ ਮੈਂ ਜੰਮੂ ਵਿੱਚ ਮਾਂ ਵੈਸ਼ਨੋ ਦੇਵੀ ਜੀ ਦੇ ਦਰਬਾਰ ਵਿੱਚ ਗਿਆ ਸੀ ਜਿਸ ਲਈ ਮੈਂ ਆਪਣੇ ਪਿੰਡ ਤੋਂ ਟ੍ਰੇਨ ਫੜ ਕੇ ਕਟਰਾ ਸਟੇਸ਼ਨ ਜੰਮੂ ਤੱਕ ਟ੍ਰੇਨ ਵਿੱਚ ਗਿਆ ਫਿਰ ਉੱਥੋਂ ਪੈਦਲ ਚੜ੍ਹਾਈ ਸਟਾਰਟ ਕੀਤੀ ਮਾਤਾ ਜੀ ਦਾ ਭਵਨ ਉੱਪਰ ਪਹਾੜਾਂ 'ਤੇ ਬਾਰ੍ਹਾਂ ਤੋਂ ਸਾਢੇ ਬਾਰ੍ਹਾਂ ਕਿਲੋਮੀਟਰ ਦੂਰ ਹੈ ਜਿਸ ਲਈ ਪੈਦਲ ਚੜ੍ਹਾਈ ਹੀ ਕਰ ਸਕਦੇ ਹਨ ਜਾਂ ਫਿਰ ਹੈਲੀਕੋਪਟਰ 'ਤੇ ਵੀ ਜਾਂਦੇ ਹਨ ਕਈ ਲੋਕ ਹੈਲੀਕੋਪਟਰ ਦਾ ਵੀ ਯੂਜ਼ ਕਰਦੇ ਹਨ ਹੁਣ ਤਾਂ ਬਹੁਤ ਨਵਾਂ ਰਾਹ ਵੀ ਬਣ ਚੁੱਕਿਆ ਹੈ ਅਤੇ ਬਹੁਤ ਸਾਰੇ ਲੋਕ ਗੱਡੀ ਵੀ ਲੈ ਕੇ ਉੱਪਰ ਜਾਂਦੇ ਹਨ ਪਰ ਅਸੀਂ ਪੈਦਲ ਹੀ ਚੜ੍ਹਾਈ ਕੀਤੀ ਜਿਸ ਵਿੱਚ ਆਪਾਂ ਛੇ ਤੋਂ ਸਾਢੇ ਛੇ ਘੰਟੇ ਵਿੱਚ ਇੱਕ ਤਰਫਾ ਚੜ੍ਹਾਈ ਚੜ੍ਹ ਚੁੱਕੇ ਸਨ ਅਤੇ ਚੜ੍ਹਦੇ ਚੜ੍ਹਦੇ ਸਾਨੂੰ ਬਹੁਤ ਚੰਗੀਆਂ ਚੰਗੀਆਂ ਚੀਜ਼ਾਂ ਵੀ ਦਿਖੀਆਂ ਉੱਥੇ ਬਾਂਦਰ ਵੀ ਬਹੁਤ ਸੀਗੇ ਪਹਾੜਾਂ 'ਤੇ ਬਹੁਤ ਵਧੀਆ ਨਜ਼ਾਰਾ ਸੀਗਾ ਪਹਾੜਾਂ ਦੇ ਉੱਤੇ ਬੱਦਲਾਂ ਵਾਲਾ ਮੌਸਮ ਸੀਗਾ ਬਹੁਤ ਵਧੀਆ ਹਵਾਵਾਂ ਚੱਲ ਰਹੀਆਂ ਸੀਗੀਆਂ ਲੋਕਾਂ ਨੇ ਖਾਣ ਪੀਣ ਦੇ ਬਹੁਤ ਵਧੀਆ ਛੋਟੀਆਂ ਛੋਟੀਆਂ ਦੁਕਾਨਾਂ ਪਹਾੜਾਂ 'ਤੇ ਹੀ ਪਾਈਆਂ ਹੋਈਆਂ ਸੀਗੀਆਂ ਅਸੀਂ ਆਰਾਮ ਕਰ ਕਰਕੇ ਰੁਕ ਰੁਕ ਕੇ ਖਾ ਖਾ ਪੀ ਕੇ ਆਪਾਂ ਚੰਗੀ ਤਰ੍ਹਾਂ ਚੜ੍ਹਾਈ ਕੀਤੀ ਅਤੇ ਮਾਤਾ ਜੀ ਦੇ ਦਰਬਾਰ ਵਿੱਚ ਆਪਾਂ ਪੰਜ ਤੋਂ ਸਾਢੇ ਪੰਜ ਘੰਟੇ ਵਿੱਚ ਪਹੁੰਚ ਚੁੱਕੇ ਸਨ